ਸਤਿ ਸ਼੍ਰੀ ਅਕਾਲ ਮੇਰਾ ਨਾਮ ਅੰਸ਼ ਮਹਾਜਨ ਹੈ ਮੈਂ ਪਠਾਨਕੋਟ ਸ਼ਹਿਰ ਦਾ ਰਹਿਣ ਵਾਲਾ ਹਾਂ ਅਤੇ ਅੱਜ ਮੈਂ ਤੁਹਾਨੂੰ ਦੱਸਣ ਜਾ ਰਿਹਾ ਹਾਂ ਕਿ ਉੱਚਾਈ ਦਾ ਫੋਬੀਆ ਕੀ ਹੁੰਦਾ ਹੈ ਉੱਚਾਈ ਦਾ ਫੋਬੀਆ ਕਿਉਂ ਹੁੰਦਾ ਹੈ ਅਤੇ ਇਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਦੁਨੀਆ ਦੀ ਪਜਵੰਜਾ ਪਰਸੈਂਟ ਆਬਾਦੀ ਨੂੰ ਉੱਚਾਈ ਦਾ ਫੋਬੀਆ ਹੁੰਦਾ ਹੈ ਮੈਂ ਵੀ ਉਹ ਪਜਵੰਜਾ ਪਰਸੈਂਟ ਆਬਾਦੀ ਵਿੱਚ ਹੀ ਆਉਂਦਾ ਹਾਂ ਕਿਉਂਕਿ ਮੈਨੂੰ ਵੀ ਉੱਚਾਈ ਦਾ ਫੋਬੀਆ ਹੈ ਮੈਂ ਵੀ ਜਦ ਕਿਤੇ ਪਹਾੜ ਉੱਚੀ ਜਗ੍ਹਾ ਜਾਂ ਕਿਤੇ ਚੜ੍ਹ ਜਾਵਾਂ ਤਾਂ ਮੈਨੂੰ ਵੀ ਡਰ ਲੱਗਣਾ ਸ਼ੁਰੂ ਹੋ ਜਾਂਦਾ ਹੈ ਮੇਰੇ ਵੀ ਸਾਹ ਔਖੇ ਹੋ ਜਾਂਦੇ ਨੇ ਅਤੇ ਇਹ ਉੱਚਾਈ ਦਾ ਫੋਬੀਆ ਜਦ ਹੁੰਦਾ ਹੈ ਤਦ ਬੰਦੇ ਦੇ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ ਉਹਦੇ ਸਾਹ ਤੇਜ਼ ਹੋ ਜਾਂਦੇ ਹੈ ਅਤੇ ਉਹਨੂੰ ਡਰ ਲੱਗਣਾ ਸ਼ੁਰੂ ਹੋ ਜਾਂਦਾ ਘਬਰਾਹਟ ਹੋਣੀ ਸ਼ੁਰੂ ਹੋ ਜਾਂਦੀ ਹੈ ਪਰ ਇਹ ਉੱਚਾਈ ਦਾ ਫੋਬੀਆ ਇਸ ਲਈ ਹੁੰਦਾ ਹੈ ਕਿਉਂਕਿ ਬੰਦੇ ਨੂੰ ਡਰ ਹੁੰਦਾ ਹੈ ਕਿ ਉਹ ਕਿਤੇ ਡਿੱਗ ਨਾ ਜਾਵੇ ਉਹ ਮਰ ਨਾ ਜਾਵੇ ਜਾਂ ਕੋਈ ਹੋਰ ਡਰ ਹੁੰਦਾ ਹੈ ਉੱਚਾਈ ਦੇ ਫੋਬੀਏ ਤੋਂ ਬਚਣ ਵਾਸਤੇ ਤੁਹਾਨੂੰ ਆਪਣਾ ਮਨ ਸ਼ਾਂਤ ਕਰਨਾ ਹੁੰਦਾ ਹੈ ਇੱਕ ਲੰਬਾ ਸਾਹ ਲੈ ਕੇ ਆਪਣੇ ਦਿਲ ਦੀ ਧੜਕਣ ਨੂੰ ਸ਼ਾਂਤ ਕਰਨਾ ਹੁੰਦਾ ਹੈ ਅਤੇ ਉਸ ਨਾਲ ਉੱਚਾਈ ਦੇ ਫੋਬੀਏ 'ਤੇ ਕਾਬੂ ਕੀਤਾ ਜਾ ਸਕਦਾ ਹੈ ਪਰ ਜੇ ਫਿਰ ਵੀ ਤੁਸੀਂ ਉੱਚਾਈ ਦੇ ਫੋਬੀਏ 'ਤੇ ਕਾਬੂ ਨਹੀਂ ਕਰ ਸਕਦੇ ਤਾਂ ਤੁਹਾਨੂੰ ਡਾਕਟਰ ਕੋਲ ਹੀ ਜਾਣਾ ਪੈਂਦਾ ਹੈ ਉੱਚਾਈ ਦੇ ਫੋਬੀਏ ਦੇ ਕਾਰਨ ਦੁਨੀਆ ਵਿੱਚ ਆਲਮੋਸਟ ਆਲਮੋਸਟ ਪ ਪੈਂਤੀ ਪਰਸੈਂਟ ਆਬਾਦੀ ਹੈ ਜਿਹੜੀ ਉੱਚੀ ਜਗਾਵਾਂ ਤੋਂ ਡਰਦੀ ਹੈ ਅਤੇ ਉੱਥੇ ਜਾਂਦੀ ਨਹੀਂ ਹੈ ਮੈਨੂੰ ਲੱਗਦਾ ਹੈ ਕਿ ਤੁਹਾਨੂੰ ਮੇਰੀ ਜਾਣਕਾਰੀ ਪਸੰਦ ਆਈ ਹੋਏਗੀ ਸ਼ੁਕਰੀਆ